ਉਬਰ ਡਰਾਈਬ ਤੋਂ ਬਲਜੀਤ ਜੀ ਬੋਲ ਰਹੇ ਹੋ ਹਾਂਜੀ ਸਰ ਮੈਂ ਆਪਣੀ ਨਾ ਬੁਕਿੰਗ ਕਰਵਾਈ ਸੀ ਕੈਬ ਦੀ ਨਿਊ ਅੰਮ੍ਰਿਤਸਰ ਦੇ ਵਿੱਚ ਵੇਰਕਾ ਬੂਥ ਦੇ ਲਾਗਿਉਂ ਹਾਂਜੀ ਤੁਸੀਂ ਉੱਥੋਂ ਪਿੱਕ ਕਰਨਾ ਸੀ ਮੈਨੂੰ ਪਰ ਤੁਸੀਂ ਜਿੱਦਾਂ ਆ ਰਹੇ ਹੋ ਮੈਂ ਮੈਪ 'ਤੇ ਦੇਖ ਰਿਹਾ ਬਟ ਇਹਨੂੰ ਥੋੜ੍ਹਾ ਜਿਹਾ ਤੁਸੀਂ ਪਿੱਕਅਪ ਲੋਕੇਸ਼ਨ ਨੂੰ ਚੇਂਜ ਕਰਨਾ ਪਵੇਗਾ ਕਿਉਂਕਿ ਮੈਂ ਜਿਹੜੀ ਮੇਨ ਮਾਰਕੀਟ ਹੈ ਨਿਊ ਅੰਮ੍ਰਿਤਸਰ ਦੀ ਉੱਥੇ ਆ ਗਿਆ ਮੈਂ ਮੈਡੀਸਨ ਲੈਣੀ ਸੀ ਉਹਦੇ ਕਰਕੇ ਅਤੇ ਮੈਂ ਰਸਤੇ 'ਚ ਤੁਹਾਨੂੰ ਰੁਕਵਾਉਣਾ ਨਹੀਂ ਸੀ ਚਾਹੁੰਦਾ ਅਤੇ ਥੋੜ੍ਹਾ ਜਿਹਾ ਤੁਰ ਕੇ ਮੈਂ ਲਗਭਗ ਅੱਧਾ ਕਿਲੋਮੀਟਰ ਅੱਗੇ ਆ ਗਿਆ ਤੁਸੀਂ ਜਦੋਂ ਨਿਊ ਅੰਮ੍ਰਿਤਸਰ ਐਂਟਰ ਕਰੋਗੇ ਤਾਂ ਵੇਰਕਾ ਬੂਥ ਵੱਲ ਜਾਣ ਦੀ ਬਜਾਏ ਉਸ ਤੋਂ ਪਹਿਲਾਂ ਹੀ ਇੱਕ ਯੂ ਟਰਨ ਮਾਰ ਕੇ ਸਟੇਟ ਬੈਂਕ ਆਫ ਇੰਡੀਆ ਦਾ ਜਿੱਥੇ ਏ ਟੀ ਐੱਮ ਹੈ ਉੱਥੇ ਪਲੀਜ਼ ਆ ਜਾਣਾ ਅਤੇ ਮੈਨੂੰ ਉੱਥੋਂ ਪਿੱਕ ਕਰ ਲੈਣਾ ਧੰਨਵਾਦ ਜੀ